ਏਸ਼ੀਆ ਯੂਰਪ ਐ ਅਫਰੀਕਾ ਉੱਤਰੀ ਅਮਰੀਕਾ ਦੱਖਣੀ ਅਮਰੀਕਾ ਓਸ਼ਨੀਆਂ ਐਨਟਾਰੀਕਾ ਭਾਰਤ ਪਾਕਿਸਤਾਨ ਚੀਨ ਅਮ ਅਮਰੀਕਾ ਕੈਨੇਡਾ ਬਰਤਾਨੀਆ ਆਸਟਰੇਲੀਆ ਰੂਸ ਫਰਾਂਸ ਜਰਮਨੀ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਉੱਤਰ ਪ੍ਰਦੇਸ਼ ਮਹਾਰਾਸ਼ਟਰ ਗੁਜਰਾਤ ਬਿਹਾਰ ਤਾਮਿਲਨਾਡੂ ਪੱਛਮੀ ਬੰਗਾਲ ਮੱਧ ਪ੍ਰਦੇਸ਼ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਟਿਆਲਾ ਬਠਿੰਡਾ ਮੋਹਾਲੀ ਮਾਨਸਾ ਸੰਗਰੂਰ ਫਿਰੋਜ਼ਪੁਰ ਹੁਸ਼ਿਆਰਪੁਰ ਦਿੱਲੀ ਮੁਬੰਈ ਕੋਲਕਾਤਾ ਚੇਨਈ ਬੰਗਲੌਰ ਹੈਦਰਾਬਾਦ ਅਹਿਮਦਾਬਾਦ ਜੈਪੁਰ ਲਖਨਊ ਚੰਡੀਗੜ੍ਹ ਨਿਊਯਾਰਕ ਲੰਦਨ ਪੈਰਸ ਦੁਬਈ ਸਿਡਨੀ ਟੋਕੀਓ ਬਰਲੀਨ ਮਾਸਕੋ ਟੋਰੰਟੋ ਕੈਲੀਫੋਰਨੀਆ ਭਿੱਖੀ ਵਿੰਡ ਸੰਘਰ ਮੂਲਪੁਰ ਡੈਹਲੋਂ ਖੰਨਾ ਕਿਸਾਨਪੁਰਾ ਰਾਏਕੋਟ ਮੰਡੀ ਗੋਬਿੰਦਗੜ੍ਹ ਸਮਰਾਲਾ ਤਲਵੰਡੀ ਸਾਭੋ ਸ੍ਰੀ ਹਰਿਮੰਦਰ ਸਾਹਿਬ ਸਾਹਿਬ ਵਾਹਗਾ ਬਾਡਰ ਜਲਿਆਂਵਾਲਾ ਬਾਗ ਕੁਲੂ ਮਨਾਲੀ ਸ਼ਿਮਲਾ ਦਾਰਜਲਿੰਗ ਨੈਨੀਤਾਲ ਉਦੈਪੁਰ ਗੋਲਕੋਡਾ ਕਿਲ੍ਹਾ ਜੈਸਲਮੇਰ ਧੰਨਵਾਦ